ਮੈਂ ਸੂਪ ਔਡਰ ਕੀਤਾ ਸੀ ਪਰ ਨਾ ਮੈਨੂੰ ਅਚਾਨਕ ਘਰੋਂ ਕੋਲ ਆ ਗਈ ਮੈਮ ਤੁਸੀਂ ਪਲੀਜ਼ ਇਹਨੂੰ ਜੇ ਪੈਕ ਕਰ ਸਕਦੇ ਹੋ ਤਾਂ ਪਲੀਜ਼ ਪੈਕ ਕਰ ਦਿਉ ਅਤੇ ਪੈਕਿੰਗ ਕੁਛ ਥੋੜ੍ਹੀ ਜਿਹੀ ਐਵੇਂ ਕਰਿਓ ਵੀ ਇਹ ਲੀਕ ਵੀ ਨਾ ਹੋਵੇ ਅਤੇ ਗਰਮ ਵੀ ਰਹੇ ਕਿਉਂਕਿ ਮੈਨੂੰ ਨਾ ਘਰ ਜਾਂਦੇ ਨੂੰ ਇੱਕ ਘੰਟੇ ਵਾਂਗੂ ਲੱਗ ਹੀ ਜਾਂਦਾ ਇੱਕ ਤਾਂ ਟ੍ਰੈਫਿਕ ਜ਼ਿਆਦਾ ਹੁੰਦੀ ਆ ਉਸ ਰੋਡ 'ਤੇ ਜਿਹੜੇ ਰੋਡ 'ਤੇ ਮੈਂ ਜਾਂਦੀ ਹਾਂ ਘਰ ਨੂੰ ਅਤੇ ਦੂਸਰਾ ਘਰ ਦੂਰ ਵੀ ਪੈ ਜਾਂਦਾ ਵੈਸੇ ਤਾਂ ਮੈਂ ਇੱਥੇ ਬਹਿ ਕੇ ਪੀਣਾ ਸੀ ਬਸ ਅਚਾਨਕ ਕੋਈ ਕੰਮ ਪੈ ਗਿਆ ਤਾਂ ਉਹਦੇ ਕਰਕੇ ਜਾਣਾ ਪਊਗਾ ਮੈਂ ਤੁਹਾਨੂੰ ਇਹਦੇ ਲਈ ਐਕਸਟਰਾ ਪੇ ਵੀ ਕਰਦੂੰ ਜੇ ਕੋਈ ਤੁਹਾਡੇ ਚਾਰਜਿਸ ਵਗੈਰਾ ਹੁੰਦੇ ਆ ਕੋਈ ਉਸ ਪੈਕਿੰਗ ਦੇ ਲਈ ਜੇ ਇਹ ਕਰ ਦਿਉ ਤਾਂ ਬੈਟਰ ਹੈ ਧੰਨਵਾਦੀ ਰਹਾਂਗੇ ਅਸੀਂ ਤੁਹਾਡੇ ਇਸ ਲਈ